ਪਹਿਲਾਂ ਤਾਂ ਮੈਂ ਮੌਲਚ ਬਾਰੇ ਦੱਸਣਾ ਚਾਹਾਂਗੀ ਮਾਲਜਿੰਗ ਇੱਕ ਵਿਆ ਵਿਆਪਿਕ ਤੌਰ 'ਤੇ ਅਭਿਆਸ ਕੀਤੀ ਬਾਗ਼ਬਾਨੀ ਦੀ ਇੱਕ ਤਕਨੀਕ ਹੈ ਜੋ ਪੌਦਿਆਂ ਲਈ ਬਹੁਤ ਲਾਹੇਵੰਦ ਹੈ ਇਹ ਸਹੀ ਢੰਗ ਨਾਲ ਕੀਤੀ ਜਾਂਦੀ ਹੈ ਜੋ ਕਿ ਨਮੀ ਨੂੰ ਬਰਕਰਾਰ ਰੱਖਦੀ ਹੈ ਮਿੱਟੀ ਨੂੰ ਮਲਚਾਂ ਜਿਵੇਂ ਕਿ ਸੱਕ ਲੱਕੜ ਦੇ ਚਿਪਸ ਅਤੇ ਹੋਰ ਜੈਵਿਕ ਪਦਾਰਥਾਂ ਨਾਲ ਢਕਣ ਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਹੈ ਮਲਚਿੰਗ ਵਿਧੀ ਅਤੇ ਇਸ ਵਿੱਚ ਸਬੰਧ ਢੁੱਕਵਾਂ ਵਿਕਲਪ ਹੈ ਜੋ ਕਿ ਸਾਰੇ ਖੇਤੀਬਾੜੀ ਖੇਤੀਬਾੜੀ ਅਤੇ ਵਾਤਾਵਰਨ ਲਾਭ ਪ੍ਰਦਾਨ ਕਰਦਾ ਹੈ ਇਸ ਮਲਚ ਵਿੱਚ ਇੱਕ ਪਦਾਰਥ ਸਮੱਗਰੀ ਨੂੰ ਜ਼ਮੀਨ 'ਤੇ ਵਿਛਾਇਆ ਜਾਂਦਾ ਹੈ ਇਸ ਤਰ੍ਹਾਂ ਵਿਛਾਉਣ ਦੀ ਵਿਧੀ ਨੂੰ ਕੀ ਮਲਚਿੰਗ ਕਿਹਾ ਜਾਂਦਾ ਹੈ ਇਸ ਦੀਆਂ ਦੋ ਕਿਸਮਾਂ ਹੁੰਦੀਆਂ ਹਨ ਜੈਵਿਕ ਮਲਚ ਅਤੇ ਅਜੈਵਿਕ ਮਲਚ ਜੈਵਿਕ ਮਲਚ ਵਿੱਚ ਪੌਦਿਆਂ ਅਤੇ ਜਾਨਵਰਾਂ ਦੇ ਮੂਲ ਪਦਾਰਥ ਹੁੰਦੇ ਹਨ ਅਜੈਵਿਕ ਮਲਚ ਵਿੱਚ ਪਲਾਸਟਿਕ ਦੀਆਂ ਸ਼ੀਟਾਂ ਹੁੰਦੀਆਂ ਹਨ ਜਿਵੇਂ ਕਿ ਪਲਾਸਟਿਕ ਫਿਲਮਾਂ ਦੇ ਰੰਗ ਕਾਲਾ ਜਾਂ ਚਿੱਟਾ ਹੋ ਗਿਆ ਅਤੇ ਹੋਰ ਕੁਛ ਮਲਚਿੰਗ ਦੇ ਲਾਭ ਕੀ ਹਨ ਨਮੀ ਦੀ ਸੰਭਾਲ ਕਰਦਾ ਇਹ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ਮਿੱਟੀ ਦਾ ਤਾਪਮਾਨ ਕੰਟਰੋਲ ਰੱਖਦਾ ਹੈ ਨਦੀਨਾ ਦੀ ਰੋਕਥਾਮ ਕਰਦਾ ਹੈ ਲੂਣੀਆ ਜ਼ਮੀਨਾਂ ਦਾ ਸੁਧਾਰ ਕਰਦਾ ਹੈ ਅਤੇ ਪੌਦਿਆਂ ਦਾ ਵਾਧਾ ਅਤੇ ਵਿਕਾਸ ਕਰਦਾ ਹੈ